ਹੈਲੋ ਸਰ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਕੌਰ ਬੋਲ ਰਹੀ ਹਾਂ ਸਰ ਮੈਂ ਆਪਣੇ ਅਕਾਉਂਟ ਵਿੱਚੋਂ ਮਵਾਇਲ ਬਿੱਲ ਭਰਿਆ ਸੀ ਰਿਚਾਰਜ ਕਰਵਾਇਆ ਸੀ ਸਰ ਉਹ ਹੋ ਨਹੀਂ ਰਿਹਾ ਕੀ ਕਾਰਨ ਹੈ ਇਸਦਾ ਸਰ ਮੈਨੂੰ ਚਿੰਤਾ ਹੋ ਰਹੀ ਹੈ ਕਿ ਮੇਰੇ ਕਾਉਂਟ ਵਿੱਚੋਂ ਪੈਸੇ ਵੀ ਕੱਟੇ ਗਏ ਪਰ ਮੇਰਾ ਰੀਚਾਰਜ ਫਿਰ ਵੀ ਨਹੀਂ ਹੋਇਆ ਇਸ ਲੀਏ ਸਰ ਕੋਈ ਮੈਨੂੰ ਮੈਂ ਜਾਣਨਾ ਚਾਹੁੰਦੀ ਹਾਂ ਕਿ ਮੇਰੇ ਕਾਉਂਟ ਵਿੱਚ ਹੁਣ ਕਿੰਨੀ ਰਕਮ ਰਹਿ ਗਈ ਹੈ ਬਕਾਇਆ ਕਿੰਨੀ ਰਕਮ ਰਹਿ ਗਈ ਹੈ ਸਰ ਕੀ ਕਾਰਨ ਹੋ ਸਕਦਾ ਹੈ ਕਿ ਮੈਂ ਦੋ ਵਾਰ ਬਿਜਲੀ ਬਿਲ ਵੀ ਭਰਿਆ ਉਹਦੇ ਵਿੱਚ ਵੀ ਇੱਦਾਂ ਦੀ ਹੀ ਪ੍ਰੋਬਲਮ ਆ ਰਹੀ ਹੈ ਸਰ ਕੋਈ ਦੇਖ ਕੇ ਤੁਸੀਂ ਦੱਸੋ ਕਿਉਂ ਮੇਰੇ ਅਕਾਉੰਟ ਵਿੱਚ ਪੇ ਬੈਲੈਂਸ ਵੀ ਹੈ ਸਰ ਦਸ ਹਜ਼ਾਰ ਰੁਪਇਆ ਹੈ ਪਰ ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ ਹਾਂਜੀ ਸਰ ਹਾਂਜੀ ਸਰ ਹਾਲ ਹੀ ਵਿੱਚ ਹੀ ਮੈਨੇ ਕੱਲ੍ਹ ਹੀ ਰਿਚਾਰਜ ਕੀਤਾ ਸੀ ਫ਼ੋਨ ਦਾ ਪਰ ਫਿਰ ਵੀ ਹਾਂਜੀ ਬੈਲਂਸ ਵੀ ਮੇਰੇ ਫੋਨ ਵਿੱਚੋਂ ਕੱਟਿਆ ਗਿਆ ਏ ਪਰ ਫਿਰ ਵੀ ਮੇਰਾ ਰੀਚਾਰਜ ਨਹੀਂ ਹੋਇਆ ਹਾਂਜੀ ਮੈਂ ਆਪਣਾ ਮੈਂ ਚਾਹੁੰਦੀ ਹਾਂ ਸਰ ਕਿ ਮੇਰੇ ਖਾਤੇ ਵਿੱਚ ਚ ਚੈੱਕ ਕੀਤਾ ਜਾਵੇ ਕਿ ਕਿੰਨੀ ਰਕਮ ਹੈ ਮੈਨੂੰ ਸਾਰੀ ਹਾਂਜੀ ਸਰ ਮੈਨੂੰ ਬੈਂਕ ਦੀ ਸਾਰੀ ਡਾਟਾ ਚਾਹੀਦਾ ਹੈ ਕਿ ਕੀ ਕੀ ਹੈ ਜਾਂ ਕੀ ਨਹੀਂ ਹੈ ਮੇਰੇ ਬੈਂਕ ਅਕਾਉਂਟ ਵਿੱਚ ਹਾਂਜੀ ਸਰ ਸਰ ਹਰ ਵਾਰ ਸਰਵਰ ਅਕਉਂਟ ਦਾ ਸਰਵਰ ਡੋਨ ਹੀ ਚੱਲਦਾ ਹੈ ਜੀ ਸਰ